ਵੈਸੇ ਤਾਂ ਮੈਂ ਆਪਣੇ ਘਰ ਤੋਂ ਬੋ ਬਹੁਤ ਹੀ ਘੱਟ ਬਾਹਰ ਜਾਂਦੀ ਹਾਂ ਪਰ ਜੇਕਰ ਮੈਨੂੰ ਕਦੇ ਛੁੱਟੀ ਹੋਵੇ ਤਾਂ ਮੈਂ ਆਪਣਾ ਸਮਾਂ ਆਪਣੇ ਦੋਸਤਾਂ ਦੇ ਨਾਲ ਬਿਤਾਉਣਾ ਪਸੰਦ ਕਰਦੀ ਹਾਂ ਕਿਉਂਕਿ ਦੋਸਤਾਂ ਵਿੱਚ ਰਹਿ ਕੇ ਕੋਈ ਬੰਦਿਸ਼ ਨਹੀਂ ਹੁੰਦੀ ਜਿਵੇਂ ਦੇ ਆਪਾਂ ਆਪ ਹੁੰਦੇ ਹਾਂ ਉਸ ਤਰ੍ਹਾਂ ਦੇ ਹੀ ਦੋਸਤ ਹੁੰਦੇ ਹਨ ਦੋਸਤਾਂ ਦੇ ਨਾਲ ਮੈਂ ਜਿਵੇਂ ਕਿ ਫਿਲਮ ਦੇਖਣਾ ਗੇਮ ਖੇਡਣਾ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਅਤੇ ਹੋਰ ਕਈ ਕੁਝ ਹੁੰਦਾ ਹੈ ਜੋ ਮੈਂ ਆਪਣੇ ਦੋਸਤਾਂ ਨਾਲ ਕਰ ਸਕਦੀ ਹਾਂ ਕਿਉਂਕਿ ਇੱਕ ਜ਼ਿੰਦਗੀ ਵਿੱਚ ਦੋਸਤ ਹੀ ਹੁੰਦਾ ਹੈ ਜਿਸ ਨਾਲ ਅਸੀਂ ਆਪਣੇ ਦਿਲ ਦੇ ਭੇਦ ਖੋਲ੍ਹ ਸਕਦੇ ਹਾਂ ਦੋਸਤ ਦੋਸਤ ਹਮੇਸ਼ਾਂ ਸੱਚਾ ਹੁੰਦਾ ਹੈ